ਮੈਂ ਜ਼ਿਆਦਾ ਤੋਂ ਜ਼ਿਆਦਾ ਬਹੁਤ ਹੀ ਜ਼ਿਆਦਾ ਪ੍ਰੇਰਨਾ ਵਾਲੇ ਗੀਤ ਸੁਣਦੀ ਹਾਂ ਜਿਸ ਵਿੱਚ ਸਾਨੂੰ ਗੀਤਾਂ 'ਚ ਪ੍ਰੇਰਨਾ ਦਿੱਤੀ ਜਾਵੇ ਅਤੇ ਜਿਸ ਨਾਲ ਸਾਡਾ ਗੀਤਾਂ ਨੂੰ ਸੁਣ ਕੇ ਸਾਡਾ ਮਨ ਸ਼ਾਂਤ ਹੋ ਜਾਵੇ ਮੈਂ ਉਸ ਤਰ੍ਹਾਂ ਦੇ ਗੀਤ ਸੁਣਦੀ ਹਾਂ ਅਤੇ ਇਹਨਾਂ ਗੀਤਾਂ ਨੂੰ ਮੈਂ ਮਤਲਬ ਇਹਨਾਂ ਗੀਤਾਂ ਦੀ ਚੋਣ ਕਰਨ ਲਈ ਮੈਂ ਯੂਟੀਊਬ ਮੈਂ ਫੋਨ ਉੱਤੇ ਗੀਤਾਂ ਨੂੰ ਲੱਭਦੀ ਹਾਂ ਅਤੇ ਇਹਨਾਂ ਗੀਤਾਂ ਨੂੰ ਆਪਣਾ ਮਨ ਸ਼ਾਂਤ ਕਰਨ ਲਈ ਅਤੇ ਆਪਣਾ ਆਪਣੇ ਆਪ ਨੂੰ ਜਦੋਂ ਮੈਂ ਡਾਊਨ ਫੀਲ ਕਰਦੀ ਹਾਂ ਤਾਂ ਉਹਨਾਂ ਉਹ ਗੀਤ ਸੁਣ ਕੇ ਮੈਂ ਆਪਣੇ ਆਪ ਨੂੰ ਪ੍ਰੇਰਿਤ ਕਰਦੀ ਹਾਂ ਤਾਂ ਇਹ ਗੀਤ ਮੈਂ ਕਈ ਵਾਰੀ ਅ ਕਈ ਵਾਰੀ ਇਸ ਗੀਤ ਨੂੰ ਮੈਂ ਆਪ ਖੁਦ ਵੀ ਗਾਉਣ ਲੱਗ ਜਾਂਦੀ ਹਾਂ ਅਤੇ ਖੁਦ ਗਾ ਕੇ ਆਪਣੇ ਆਪ ਨੂੰ ਰਿਕਾਰਡ ਵੀ ਕਰਦੀ ਹਾਂ ਅਤੇ ਕਈ ਜਾਂ ਉਹ ਗੀਤ ਨੂੰ ਮੈਂ ਡਾਊਨਲੋਡ ਕਰਕੇ ਦੁਬਾਰਾ ਦੁਬਾਰਾ ਸੁਣਦੀ ਹਾਂ